ਦਸ ਬਾਰ੍ਹਾਂ ਸਾਲ ਪਹਿਲਾਂ ਮੈਂ ਆਪਣੇ ਘਰ ਥੋੜ੍ਹੇ ਗਮਲੇ ਲ ਖ਼ਰੀਦੇ ਅਤੇ ਉਹਨਾਂ ਵਿੱਚ ਫੁੱਲਾਂ ਦੇ ਨਾਲ ਨਾਲ ਇੱਕ ਅੰਗੂਰ ਦੀ ਵੇਲ ਲਗਾਈ ਜਦੋਂ ਉਹਨੂੰ ਅੰਗੂਰ ਲੱਗੇ ਅਤੇ ਮਨ ਇੰਨਾਂ ਖੁਸ਼ ਹੋਇਆ ਮਨ ਹੋਰ ਚੀਜ਼ਾਂ ਵੀ ਲਗਾਉਣ ਨੂੰ ਕਰਨ ਲੱਗਾ ਫਿਰ ਮੈਂ ਕਿਆਰੀ ਵਾਲੇ ਗਮਲੇ ਲਿਆਈ ਅਤੇ ਉਹਨਾਂ ਵਿੱਚ ਪਾਲਕ ਧਨੀਆ ਅਤੇ ਪੁਦੀਨਾ ਲਗਾਇਆ ਫਿਰ ਔਲ ਹੌਲੀ ਹੌਲੀ ਉਹਨਾਂ ਨੂੰ ਵਧਾਇਆ ਅਤੇ ਗਰਮੀਆਂ ਵਿੱਚ ਇੱਕ ਕਰੇਲੇ ਦੀ ਵੇਲ ਵੀ ਲਾ ਲਈ ਜਿਸ 'ਤੇ ਬਹੁਤ ਛੋਟੇ ਛੋਟੇ ਕਰੇਲੇ ਲੱਗੇ ਪਰ ਮੇਰਾ ਇਹ ਸ਼ੌਂਕ ਵੱਧਦਾ ਗਿਆ ਅਤੇ ਗਮਲੇ ਵਿੱਚ ਹੀ ਭਿੰਡੀਆਂ ਲਗਾ ਲਈਆਂ ਫਿਰ ਇੱਕ ਦਿਨ ਪਤੀ ਦੇਵ ਜੀ ਨੇ ਕਿਹਾ ਕਿ ਘਰ ਦੇ ਨਾਲ ਵਾਲੇ ਪਲਾਟ ਵਿੱਚ ਕੁਝ ਲਗਾਈਏ ਅਤੇ ਅਸੀਂ ਸਾਰਿਆਂ ਨੇ ਉਸ ਪਲਾਟ ਦੀ ਮਿਲ ਕੇ ਸਫਾਈ ਕੀਤੀ ਅਤੇ ਉਹ ਦਿਨ ਅਤੇ ਅੱਜ ਦਿ ਦਾ ਦਿਨ ਆਪਾਂ ਆਪਣਾ ਸਾਰਾ ਵਾਧੂ ਸਮਾਂ ਉਹਦੇ ਵਿੱਚ ਹੀ ਗੁਜ਼ਾਰਦੇ ਹਾਂ ਪਹਿਲਾਂ ਪਹਿਲ ਤਾਂ ਮੇਰੇ ਬੱਚਿਆਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਸੀ ਪਰ ਹੁਣ ਤਾਂ ਉਹ ਵੀ ਸਾਡੀ ਪੂਰੀ ਮਦਦ ਕਰਨ ਲੱਗੇ ਨੇ ਫਿਰ ਖੁਸ਼ੀ ਦਾ ਟਿਕਾਣਾ ਉਦੋਂ ਕੋਈ ਨਾ ਰਿਹਾ ਜਦੋਂ ਆਪਣੇ ਬਗੀਚੇ ਦੇ ਵਿੱਚ ਮੈਂ ਸੂਰਜਮੁਖੀ ਦੇ ਫੁੱਲ ਲਗਾਏ ਅਤੇ ਉਸਦੇ ਅੰਦਰ ਅਸੀਂ ਛੱਲੀਆਂ ਪਪੀਤੇ ਆਂਵਲਾ ਅਰਬੀ ਹਲਦੀ ਬੀਨਸ ਅਤੇ ਪਤਾ ਨਹੀਂ ਹੋਰ ਕਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਸਬਜ਼ੀਆਂ ਵੀ ਲਗਾਈਆਂ ਹੁਣ ਤਾਂ ਇਹੋ ਜਿਹੀ ਹਾਲਤ ਹੈ ਕਿ ਬਾਹਰ ਦੀ ਸਬਜ਼ੀ ਲਿਆ ਕੇ ਖਾਣ ਦਾ ਦਿਲ ਹੀ ਨਹੀਂ ਕਰਦਾ ਕਿਉਂਕਿ ਜੋ ਘਰ ਦਾ ਬਣਿਆ ਸਵਾਦ ਹੁੰਦਾ ਉਹ ਵੀ ਘਰ ਦੇ ਬਗੀਚੇ ਦਾ ਉਹ ਮਜ਼ਾ ਕੁਝ ਹੋਰ ਹੀ ਹੁੰਦਾ ਜਿਹੜਾ ਬਜ਼ਾਰ ਦੀਆਂ ਦਵਾਈਆਂ ਵਾਲੀਆਂ ਸਬਜ਼ੀਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਆਉਂਦਾ